ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਅੱਛਾ ਜੀ ਕਿਹੜੇ ਸਬਜੈਕਟ 'ਚ ਜੀ ਅੱਛਾ ਜੀ ਅੱਛਾ ਜੀ ਸ਼ਰਾਰਤਾਂ ਵੀ ਕਰਦਾ ਹੈ ਸਕੂਲ 'ਚ ਘਰ ਵੀ ਇਹਦਾ ਇਹੀ ਹਾਲ ਹੈ ਜੀ ਅਸੀਂ ਵੀ ਬਹੁਤ ਅੱਕੇ ਹੋਏ ਹਾਂ ਇਹਦੇ ਤੋਂ ਅੱਛਾ ਜੀ ਅੱਛਾ ਜੀ ਅੱਛਾ ਜੀ ਟਿਊਸ਼ਨ ਦੀ ਵੀ ਲੋੜ ਹੈ ਜੀ ਅਸੀਂ ਰੱਖਵਾ ਦਿੰਦੇ ਹਾਂ ਅੱਛਾ ਜੀ ਅੱਛਾ ਜੀ ਅਤੇ ਬਾਕੀ ਬੱਚਿਆਂ ਦਾ ਕੀ ਰਿਜ਼ਲਟ ਆਇਆ ਨੰਬਰ ਆਏ ਆ ਜੀ ਇਹਦੇ ਜਿਹੜੇ ਕਲਾਸਮੇਟ ਸੀਗੇ ਅੱਛਾ ਜੀ ਅੱਛਾ ਜੀ ਠੀਕ ਅੱਛਾ ਜੀ

ਅੱਛਾ ਜੀ ਜਦੋਂ ਇਹਨਾਂ ਦੇ ਨੈਕਸਟ ਕਦ ਆਊਗੀ ਪੇਪਰਾਂ ਦੀ ਅੱਛਾ ਜੀ

ਅੱਛਾ ਜੀ ਕੋਈ ਨਾ ਮੈਂ ਸਕੂਲ 'ਚ ਆਉਂਗਾ ਮਿਲ ਕੇ ਜਾਊਂਗਾ ਅੱਛਾ ਜੀ ਅੱਛਾ ਜੀ ਅਤੇ ਰਿਪੋਰਟ ਕਾਰਡ ਇਹਨਾਂ ਦਾ ਹੁਣ ਤੁਸੀਂ ਔਨਲਾਈਨ ਸੈਂਡ ਕਰੋਗੇ ਕਿ ਸਕੂਲ 'ਚ ਖੁਦ ਸਾਈਨ ਕਰਕੇ ਲੈ ਕੇ ਆਵਾਂ ਅੱਛਾ ਅੱਛਾ ਜੀ ਠੀਕ ਹੈ ਜੀ ਚਲੋ ਕੋਈ ਨਹੀਂ ਅਪਡੇਟ ਜੀ ਅੱਛਾ ਜੀ ਅੱਛਾ ਜੀ ਜੇ ਕੋਈ ਅਪਡੇਟ ਹੋਈ ਤਾਂ ਦੱਸਿਓ ਜ਼ਰੂਰ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਈ